ਹਾਂਜੀ ਮੈਨੂੰ ਏ ਆਈ ਬਾਰੇ ਕੁਛ ਬਹੁਤ ਕੁਛ ਪਤਾ ਹੈ ਏ ਆਈ ਦਾ ਮਤਲਬ ਆਰਟੀਫਿਸ਼ਲ ਇੰਟੈਲੀਜੈਂਸੀ ਕੰਪਿਊਟਰ ਦੇ ਯੁੱਗ ਦੇ ਵਿੱਚ ਅੱਜ ਕੱਲ੍ਹ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਜਿਹੜੀ ਆਰਟੀਫਿਸ਼ਲ ਏਜੰਸੀ ਤੋਂ ਬਿਨਾਂ ਹੋਵੇ ਜਿਵੇਂ ਕਿ ਹਰ ਚੀਜ਼ ਦੇ ਫਾਇਦੇ ਅਤੇ ਹਰ ਚੀਜ਼ ਦੇ ਨੁਕਸਾਨ ਹਨ ਇਸ ਕਰਕੇ ਆਰਟੀਫਿਸ਼ਲ ਏਜੰਸੀ ਦੇ ਆਪਦੇ ਆਪਦੇ ਫਾਇਦੇ ਅਤੇ ਆਪਦੇ ਨੁਕਸਾਨ ਹਨ ਜੇ ਆਪਾਂ ਫਾਇਦਿਆਂ ਦੀ ਗੱਲ ਕਰੀਏ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਓਪਰੇਸ਼ਨ ਆਰਟੀਫਿਸ਼ਲ ਅਡੇ ਅਟੈਲੀਜੈਂਸੀ ਦੇ ਸਹਾਰੇ ਕੀਤੇ ਜਾ ਸਕਦੇ ਹਨ ਕਿਉਂਕਿ ਬੋ ਪਹਿਲਾਂ ਬਹੁਤ ਸਾਰੀ ਓਪਰੇਸ਼ਨ ਇਹੋ ਜਿਹੇ ਹੁੰਦੇ ਸਨ ਜਿੱਥੇ ਕਹਿ ਦੀ ਕੋਈ ਯੰਤਰ ਨਹੀਂ ਪਹੁੰਚ ਸਕਦਾ ਸੀ ਪਰ ਅੱਜ ਕੱਲ੍ਹ ਆਪਾਂ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਸਹਾਰੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਕਿਸੇ ਨੂੰ ਵੀ ਓਪਰੇਸ਼ਨ ਦੇ ਵਿੱਚ ਸਹਾਇਤਾ ਕਰ ਸਕਦੇ ਹਾਂ ਪਰ ਜਿਵੇਂ ਕਿ ਹਰ ਚੀਜ਼ ਦੇ ਕੋਈ ਨਾ ਕੋਈ ਫਾਇਦੇ ਅਤੇ ਉਹਦੇ ਨਾਲ ਕੋਈ ਨਾ ਕੋਈ ਨੁਕਸਾਨ ਜੁੜੇ ਹੁੰਦੇ ਹੋਨ ਇਸੇ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਵੀ ਆਪਦੇ ਬਹੁਤ ਨੁਕਸਾਨ ਹਨ ਕਿਉਂਕਿ ਆਰਟੀਫਿਸ਼ਲ ਇੰਟੈਲੀਜੈਂਸੀ ਸਾਡੇ 'ਤੇ ਇੰਨੀ ਜ਼ਿਆਦਾ ਹਾਵੀ ਹੋ ਰਹੀ ਹੈ ਕਿ ਸਾਨੂੰ ਐਂ ਲੱਗਦਾ ਕਿ ਸਾਨੂੰ ਆਪਦੇ ਹੱਥੀਂ ਕੋਈ ਕੰਮ ਕਰਨਾ ਹੀ ਨਾ ਪਵੇ ਹਰ ਚੀਜ਼ ਦਾ ਇੱਕ ਬਟਨ ਹੋਵੇ ਜਿਸ ਨੂੰ ਦਬਾਈਏ ਤਾਂ ਸਾਰੇ ਕੰਮ ਆਪਦੇ ਆਪ ਹੋ ਜਾਣ ਮੈਨੂੰ ਇੰਝ ਲੱਗਦਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਆਉਣ ਨਾਲ ਲੋਕਾਂ ਦੀ ਹੱਥੀਂ ਕਿਰਤ ਜਾਂ ਲੋਕ ਜਿਹੜੀਆਂ ਆਪਦੀਆਂ ਰਚਨਾਵਕ ਰੁਚੀ ਸੀ ਉਹ ਬਿਲਕੁਲ ਖਤਮ ਹੋ ਹੋ ਚੁੱਕੀ ਹੈ ਸਭ ਨੂੰ ਐਏਂ ਲੱਗਦਾ ਹੈ ਕਿ ਇਹੋ ਜਿਹਾ ਕੋਈ ਰਿਮੋਟ ਹੋਵੇ ਜਿਹਦੇ ਨਾਲ ਸਭ ਕੁਛ ਬਣ ਜੇ ਢਹਿ ਜੇ ਸਾਨੂੰ ਆਪਦੀ ਹੱਥੀਂ ਕੁਝ ਨਾ ਕਰਨਾ ਪਵੇ ਲੋਕ ਆਪਦੇ ਆਪ ਨੂੰ ਸੋ ਆਪਦੇ ਆਪ ਬਾਰੇ ਕੁਛ ਸੋਚਦੇ ਹੀ ਨਹੀਂ ਕਿ ਉਹ ਆਪਦੀ ਦਿਮਾਗ ਦੀ ਮਦਦ ਦੇ ਨਾਲ ਵੀ ਬਹੁਤ ਕੁਛ ਕਰ ਸਕਦੇ ਹਨ ਉਹਨਾਂ ਨੂੰ ਐਏਂ ਲੱਗਦਾ ਹੈ ਕਿ ਜਿਵੇਂ ਕੰਪਿਊਟਰ ਹੈ ਕੰਪਿਊਟਰ ਵੀ ਇੱਕ ਆਰਟੀਫਿਸ਼ਲ ਇੰਟੈਲੀਜੈਂਸੀ ਹੀ ਹੈ ਜਿਸ ਨੂੰ ਅਸੀਂ ਕਮਾਂਡ ਦੇ ਦਿੰਦੇ ਹਾਂ ਤਾਂ ਉਹ ਆਪਦੇ ਆਪ ਕੰਮ ਕਰ ਦਿੰਦਾ ਹੁਨ ਅੱਜ ਕੱਲ੍ਹ ਸਭ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਆਰਟੀਫਿਸ਼ਲ ਇ ਇੰਟੈਲੀਜੈਂਸੀ ਨੂੰ ਯੂਜ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਸਕਦੀ ਸਾਡੀ ਜ਼ਿੰਦਗੀ ਤਾਂ ਸੌਖੀ ਹੋ ਰਹੀ ਹੈ ਪਰ ਜਿਹੜੀ ਸਾਡੀ ਆਪਦੀ ਦਿਮਾਗ ਦੀ ਕਹਿ ਦਈਏ ਵਾਧਾ ਜਾਂ ਵਿਕਾਸ ਉਹ ਇੱਕ ਤਰ੍ਹਾਂ ਨਾ ਰੁਕ ਰਿਹਾ ਹੈ ਅਸੀਂ ਕੁਛ ਨਵਾਂ ਸੋਚ ਹੀ ਨਹੀਂ ਪਾਉਂਦੇ ਕਿ ਹਾਂ ਇੰਝ ਚੀਜ਼ਾਂ ਕੀਤੀਆਂ ਜਾ ਸਕਦੀਆਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਰਟੀਫਿਸ਼ਲ ਇੰਟੈਲੀਜੈਂਸੀ 'ਤੇ ਨਿਰਭਰ ਹੁੰਦੇ ਜਾ ਰਹੇ ਹਾਂ